ਹੈਲੋ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਸਰ ਨਮਸਕਾਰ ਸਰ ਹਾਂਜੀ ਬਿਲਕੁਲ ਜੀ ਮੋਸਟ ਵੈਲਕਮ ਹੈ ਜੀ

ਇੱਕ ਵੈਸੇ ਤਾਂ ਜਿਹੜੇ ਨਾ ਮੈਨੂਫੈਕਚਰਿੰਗ ਸੈਕਟਰ ਬੜਾ ਅੱਛਾ ਚੱਲ ਰਿਹਾ ਜੀ ਮੈਨੂਫੈਕਚਰਿੰਗ ਸੈਕਟਰ ਹੈਗਾ ਇਲੈਕਟਰੀਕਲ ਵਹੀਕਲ ਸੈਕਟਰ ਹੈਗਾ ਐਗਰੀਕਲਚਰ ਸੈਕਟਰ ਹੈਗਾ ਵੈਸੇ ਜਿਹੜਾ ਸਭ ਤੋਂ ਵਧੀਆ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿਉਂਕਿ ਨਾ ਇੱਕ ਸ਼ੁਰੂ ਤੋਂ ਚੱਲਦਾ ਰਿਹਾ ਰੋਟੀ ਕੱਪੜਾ ਔਰ ਮਕਾਨ ਇਹ ਤਿੰਨ ਐਸੇ ਆ ਜਿਹੜੇ ਹਮੇਸ਼ਾ ਇਨਸਾਨ ਦੀ ਜ਼ਰੂਰਤ ਰਹੀ ਹੈ ਅਗਰ ਆਪਾਂ ਮੈਨੂੰਫੈਕਚਰਿੰਗ ਕਰਦੇ ਹਾਂ ਕਦੇ ਉਹ ਭੁਲਾ ਨਾਲ ਵੀ ਜਾ ਸਕਦਾ ਕਦੇ ਵੱਧਦੇ ਲਈ ਵੀ ਜਾ ਸਕਦਾ ਇਸੇ ਤਰ੍ਹਾਂ ਇਲੈਕਟਰੀਕਲ ਵਹੀਕਲ ਟੈਕਨੋਲੋਜੀ ਹੈ ਹੋ ਸਕਦਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਸਕਸੈਸ ਨਾ ਹੋਵੇ ਉਹਦੀ ਦਿੱਕਤ ਆ ਸਕਦੀ ਹੈ ਹਾਈਡਰੋਜਨ ਟੈਕਨੋਲੋਜੀ ਚੱਲ ਰਹੀ ਹੈ ਹੋ ਸਕਦਾ ਵੀ ਉਹ ਚੱਲੇ ਨਾ ਚੱਲੇ ਲੇਕਿਨ ਇੱਕ ਰੋਟੀ ਦੇ ਰਿਲੇਟਿਡ ਆਪਾਂ ਗੱਲ ਕਰੀਏ ਉਹ ਹਮੇਸ਼ਾ ਖਾਣੀ ਹੀ ਖਾਣੀ ਇਨਸਾਨ ਨੇ ਚੱਲਣਾ ਹੀ ਚੱਲਣਾ ਅਗਰ ਤੁਸੀਂ ਐਗਰੀ ਸੈਕਟਰ ਵੱਲ ਜਾਓ ਨਾ ਤਾਂ ਮੇਰੀ ਰਿਕਮੈਂਡੇਸ਼ਨ ਹੈ ਕਿ ਬਹੁਤ ਅੱਛਾ ਹੈ ਉੱਧਰਲੇ ਪਾਸੇ ਜਾਣਾ ਚਾਹੀਦਾ ਐਗਰੀਕਲਚਰ ਵਾਲੇ ਪਾਸੇ ਹਾਂ ਇੱਕ ਤਾਂ ਦੇਖੋ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਇਸ ਟਾਈਮ ਕਿਉਂਕਿ ਗ੍ਰੋਥ ਹੈਗੀ ਹੈ ਮੋਦੀ ਨੇ ਆਉਣਾ ਹੈ ਨਾ ਅਗਰ ਆਪਾਂ ਲੈ ਕੇ ਚਲੀਏ ਵੀ ਹੋ ਸਕਦਾ ਵੀ ਇਹ ਹੀ ਗਵਰਮੈਂਟ ਰਿਪੀਟ ਹੋ ਜਾਵੇ ਅਤੇ ਜੋ ਜੋ ਚੱਲ ਰਹੀ ਹੈ ਵੀ ਟਵੈਂਟੀ ਫੋਰਟੀ ਸੈਵਨ ਦਾ ਟਾਰਗੇਟ ਚੱਲ ਰਿਹਾ ਵੀ ਗਰੋਥ ਹੋਵੇਗੀ ਔਰ ਜੀ ਡੀ ਪੀ ਜਿਹੜੀ ਆਪਣੀ ਉਹ ਇਨਕਰੀਜ ਕਰ ਰਹੀ ਹੈ ਪੁਆਇੰਟ ਫਾਈਵ ਪ੍ਰਸੈਂਟ ਦੇ ਹਿਸਾਬ ਦੇ ਨਾਲ ਤਾਂ ਅਲਟੀਮੇਟਲੀ ਆਪਾਂ ਇੱਕ ਗਰੋਇੰਗ ਸਟੇਟ 'ਚ ਆ ਜਾਵਾਂਗੇ ਟਾਈਮ ਹੋ ਜਾਏ ਟਵੈਲਵ ਟਵੈਲਥ ਕੰਟਰੀ 'ਚ ਕਨਵਰਟ ਹੋ ਜਾਵਾਂਗੇ ਟਵੈਂਟੀ ਫੋਰਟੀ ਸੈਵਨ ਤੱਕ ਉਹਦੇ ਵਾਸਤੇ ਮੈਨੂਫੈਕਚਰਿੰਗ ਬਹੁਤ ਜ਼ਰੂਰੀ ਹੈ ਉਹ ਹੋਣੀ ਹੀ ਹੋਣੀ ਹੈ ਅਤੇ ਮੈ ਰੈਕਮੈਂਡ ਕਰੂੰਗਾ ਕਿ ਮੈਨੂਫੈਕਚਰਿੰਗ ਸੈਕਟਰ ਦੀ ਵਿੱਚ ਗੀਅਰ ਜਿਹੜੇ ਬਹੁਤ ਚੱਲਦੇ ਆ ਗੇਅਰ ਸੈਕਟਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਹੈ ਨਾ ਬੈਲਟ ਬਹੁਤ ਯੂਜ ਹੋਣਗੀਆਂ ਅਤੇ ਇਸ ਤਰ੍ਹਾਂ ਕਰ ਸਕਦੇ ਹੋ ਇੱਕ ਤੁਸੀਂ ਤਾਲਨਾ ਸਲਿਊਸ਼ਨ ਹੈ ਜਿਹੜਾ ਮਤਲਬ ਗੇਮਿੰਗ ਦੇ ਵਿੱਚ ਹੈ ਕਿਉਂਕਿ ਬੱਚਿਆਂ ਨੇ ਗੇਮ ਖੇਡਣੀ ਹੈ ਕੋਈ ਇੰਟਰਟੇਨਮੈਂਟ ਕਦੇ ਬੰਦ ਨਹੀਂ ਹੋ ਸਕਦਾ ਤਾਲਨਾ ਸਲਿਊਸ਼ਨ ਤੁਸੀਂ ਉਹ ਯੂਜ਼ ਕਰ ਸਕਦੇ ਹੋ ਅਤੇ ਮੈਨੂਫੈਕਚਰਿੰਗ ਦੇ ਵਿੱਚ ਗੇਅਰ ਦੇ ਵਿੱਚ ਕੋਈ ਵੀ ਤੁਸੀਂ ਜਿਹੜਾ ਵੀ ਕੋਈ ਸੈਕਟਰ ਚੂਜ ਕਰਨਾ ਚਾਹੋ ਆਟੋ ਓਵੀਨੈਂਸਰੀ ਵਾਲਾ ਸੈਕਟਰ ਚੂਸ ਕਰਨਾ ਚਾਹੋ ਇਹ ਕੀਤੇ ਜਾ ਸਕਦੇ ਹੈ ਜੀ ਹਾਂਜੀ ਹਾਂ ਐਗਰੀ ਦੇ ਵਿੱਚ ਮੈਂ ਇਹ ਰਿਕਮੈਂਡ ਕਰਾਂਗਾ ਕਿ ਫਿਫਟੀ ਕਰੋ ਮੈਨੂਫੈਕਚਰਿੰਗ 'ਚ ਥਰਟੀ ਕਰ ਲਓ ਅਤੇ ਉਸ ਤੋਂ ਬਾਅਦ ਬਾਕੀ ਜਿਹੜੇ ਮਸ਼ਲਿਨਿਸ ਆ ਉਹ ਤੁਸੀਂ ਟਵੈਂਟੀ ਪਰਸੈਂਟ ਕਰ ਸਕਦੇ ਹਾਂਜੀ ਹਾਂਜੀ ਹਾਂ ਓਕੇ ਸਰ ਓਕੇ ਜੀ ਹਾਂ ਥੈਂਕ ਯੂ ਸਰ ਥੈਂਕ ਯੂ ਜੀ ਓਕੇ ਜੀ